ਮਿੱਟੀ ਦੇ ਭਾਂਡੇ ਮਿੱਟੀ ਦੇ ਭਾਂਡੇ ਬਣਾਉਣਾ ਇੱਕ ਕਲਾ ਹੈ ਇਹ ਮਿੱਟੀ ਤੋਂ ਬਣਦੇ ਹਨ ਇਹ ਦੇਖਣ ਵਿੱਚ ਬਹੁਤ ਹੀ ਸੋਹਣੇ ਲੱਗਦੇ ਹਨ ਇਨ੍ਹਾਂ ਨੂੰ ਬਣਾਉਣ ਵਿੱਚ ਬਹੁਤ ਮਿਹਨਤ ਲੱਗਦੀ ਹੈ ਮਿੱਟੀ ਦੇ ਭਾਂਡੇ ਘੁਮਿਆਰ ਚੱਕ 'ਤੇ ਬਣਾ ਬਣਾਉਂਦਾ ਹੈ ਇਹ ਬਹੁਤ ਗੁਣੀ ਹੁੰਦੇ ਹਨ ਮਿੱਟੀ ਦੇ ਭਾਂਡਿਆਂ ਵਿੱਚ ਬਣੇ ਭੋਜਨ ਦਾ ਸੁਆਦ ਬਹੁਤ ਹੀ ਵਧੀਆ ਹੁੰਦਾ ਹੈ ਘੁਮਿਆਰ ਮਿੱਟੀ ਦੇ ਭਾਂਡੇ ਨੂੰ ਬਣਾਉਣ ਤੋਂ ਬਾਅਦ ਬਹੁਤ ਹੀ ਸੋਹਣੇ ਤਰੀਕੇ ਨਾਲ ਸਜਾਉਂਦਾ ਹੈ ਜਿਸ ਨਾਲ ਮਿੱਟੀ ਦਾ ਭਾਂਡਾ ਬਹੁਤ ਹੀ ਜ਼ਿਆਦਾ ਸੋਹਣਾ ਲੱਗਦਾ ਹੈ ਅਤੇ ਬਹੁਤ ਹੀ ਜ਼ਿਆਦਾ ਮਨ ਨੂੰ ਭਾਉਂਦਾ ਹੈ ਤਰਖਾਣ ਤਰਖਾਣ ਦੇ ਮੁੱਖ ਕੰਮ ਹਨ ਲੱਕੜ ਲੋਹਾ ਰਾਜ ਮਿਸਤਰੀ ਅਤੇ ਲਕ ਖੇਤੀਬਾੜੀ ਪੰਜਾਬ ਦੇ ਲੁਹਾਰ ਜਾਂ ਲੁਹਾਰ ਨੂੰ ਤਰਖਾਣ ਹਨ ਉਹ ਤਰਖਾਣ ਹਨ ਜੋ ਲੋਹੇ ਦਾ ਕੰਮ ਕਰਦੇ ਹਨ ਉਨ੍ਹਾਂ ਨੂੰ ਲੁਹਾਰ ਤਨ ਤਰਖਾਣ ਵੀ ਕਿਹਾ ਜਾਂਦਾ ਹੈ ਸਿੱਖ ਇਤਿਹਾਸ ਵਿੱਚੋਂ ਇਨ੍ਹਾਂ ਦੀ ਵਿਲੱਖਣਤਾ ਦੇ ਉਦਾਹਰਣ ਬੜੇ ਸਾਫ਼ ਮਿਲਦੇ ਹਨ ਜਿਸਨੂੰ ਭਾਈ ਲਾਲੋ ਜੀ ਨੇ ਕੱਟੋ ਕੱਟੋੜਾ ਦਾ ਕਿੱਤਾ ਲੱਕੜ ਦਾ ਕੰਮ ਸੀ ਇਹ ਗੁਰੂ ਨਾਨਕ ਦੇਵ ਜੀ ਦਾ ਪਹਿਲਾ ਸਿੱਖ ਸੀ ਭਾਈ ਬਾਬਾ ਭਾਈ ਰੂਪ ਚੰਦ ਜੀ ਜੀ ਜੋ ਕਿ ਖੇਤੀਬਾੜੀ ਵਾਲੇ ਕਿਸਾਨ ਸਨ ਬਾਬਾ ਹਰਦਾਸ ਜੀ ਵਰਮਾ ਜਿਹਨੇ ਨਾਗਣੀ ਬਰਛਾ ਬਣਾਇਆ ਸੀ ਮਸਤ ਹਾਥੀ ਦੇ ਮਾਰਿਆ ਗਿਆ ਅਤੇ ਬਾਬਾ ਜੀ ਆਪ ਲਿਖਾਰੀ ਸਨ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਬਹੁਤ ਕਰੀਬੀ ਹਨ ਮਿਸਤਰੀ ਦੇਸਰਾਜ ਕਲਸੀ ਸੁਰ ਸੁਰਸੀ ਸੁਰਸਿੰਘ ਪਿੰਡ ਵਾਲਾ ਜਿਨ੍ਹਾਂ ਨੇ ਅਕਾਲ ਤਖ਼ਤ ਨੂੰ ਬਣਾਉਣ ਵਿੱਚ ਬਹੁਤ ਵੱਡਾ ਯੋਗਦਾਨ ਦਿੱਤਾ ਅਤੇ ਬਾਅਦ ਵਿੱਚ ਅਬਦਾਲੀ ਦੁਆਰਾ ਉਸਨੂੰ ਤਬਾਹ ਕੀਤਾ ਗਿਆ